ਹੈਲੋ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਹਾਂ ਹਾਂ ਬੇਟਾ ਜ਼ਰੂਰ ਦੱਸਾਂਗੇ ਇੱਥੋਂ ਦੇ ਤਾਂ ਜਿਹੜੇ ਗੁਰਦੁਆਰੇ ਆ ਬਹੁਤ ਹੀ ਮਸ਼ਹੂਰ ਹੈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇੱਥੋਂ ਦਾ ਜਿਹੜੇ ਮੇਨ ਗੁਰਦੁਆਰਾ ਹੈ ਦਰਬਾਰ ਸਾਹਿਬ ਗੋਲਡਨ ਟੈਂਪਲ ਜਿਹਨੂੰ ਅਸੀਂ ਕਹਿੰਦੇ ਹਾਂ ਹਰਿਮੰਦਰ ਸਾਹਿਬ ਜਿਹਨੂੰ ਕਿਹਾ ਜਾਂਦਾ ਹੈ ਇਹ ਤਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਲੋਕੀਂ ਇੱਥੇ ਨਤਮਸਤਕ ਹੋਣ ਆਉਂਦੇ ਆ ਔਰ ਇਸਦਾ ਦਰਸ਼ਨਾ ਦਾ ਆਨੰਦ ਲੈਣ ਵੀ ਆਉਂਦੇ ਆ ਅੱਜ ਮੈਂ ਤੁਹਾਨੂੰ ਹੁਣ ਉਹਨਾਂ ਬਾਰੇ ਦੱਸਾਂਗੀ ਗੁਰਦੁਆਰੇ ਬਾਰੇ ਇਹ ਗੁਰਦੁਆਰਾ ਜਿਹੜਾ ਹੈ ਉਹ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਣਵਾਇਆ ਸੀ ਇੱਕ ਸਰੋਵਰ ਦੇ ਆਲੇ ਦੁਆਲੇ ਅਤੇ ਜਿਸ ਦੀ ਨੀਂਹ ਉਹਨਾਂ ਨੇ ਅਠਾਈ ਦਸੰਬਰ ਪੰਦਰ੍ਹਾਂ ਸੌ ਅਠਾਸੀ ਨੂੰ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਸੀ ਇਹ ਜਿਹੜਾ ਗੁਰਦੁਆਰਾ ਹੈ ਇਹਦੇ ਵਿੱਚ ਇੱਕ ਹਿਸਟਰੀ ਇਹਨਾਂ ਦੀ ਹੈ ਕਿ ਇੱਥੇ ਪਿੰਗਲਾ ਸੀ ਉਹ ਬਿਲਕੁਲ ਠੀਕ ਹੋ ਗਿਆ ਸੀ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਜਦੋਂ ਉਹ ਉਸ ਨੇ ਦੇਖਿਆ ਕਿ ਇੱਕ ਕਊਆ ਜਿਹੜਾ ਹੈਗਾ ਕਾਂ ਇਹਦੇ ਵਿੱਚ ਚੁੱਬੀ ਲਗਾਉਂਦਾ ਅਤੇ ਉਹ ਹੰਸ ਬਣ ਕੇ ਬਾਹਰ ਨਿਕਲਦਾ ਅਤੇ ਉਹ ਪਿੰਗਲੇ ਨੇ ਵੀ ਇਹਦੇ ਵਿੱਚ ਚੁੱਬੀ ਲਗਾਈ ਅਤੇ ਉਹ ਵੀ ਠੀਕ ਹੋ ਗਿਆ ਅਤੇ ਜਿਹਦੇ ਨਾਲ ਇਸ ਦੀ ਪਵਿੱਤਰਤਾ ਹੋਰ ਵੱਧ ਗਈ ਅਤੇ ਚੌਥੇ ਪਾਤਸ਼ਾਹ ਜੀ ਨੇ ਇਸ ਜਗ੍ਹਾ 'ਤੇ ਜਿਹੜਾ ਗੁ ਹਰਿਮੰਦਰ ਸਾਹਿਬ ਬਣਵਾਇਆ ਅਤੇ ਗੁਰੂ ਅ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਇੱਕ ਆਦਿ ਗ੍ਰੰਥ ਦੇ ਖਰੜੇ ਦਾ ਵੀ ਪ੍ਰਕਾਸ਼ ਕੀਥਾ ਕੀਤਾ ਸੀ ਅਤੇ ਸਾਨੂੰ ਤੀਰਥ ਦਾ ਨਾਮ ਹੀ ਦਿੱਤਾ ਗਿਆ ਔਰ ਇੱਕ ਹੋਰ ਤੁਹਾਨੂੰ ਮੈਂ ਗੁਰਦੁਆਰੇ ਬਾਰੇ ਦੱਸਾਂਗੀ ਬੇਟਾ ਜਿਹੜਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹਨੂੰ ਅਸੀਂ ਸ਼ਹੀਦਾਂ ਸਾਹਿਬ ਕਹਿੰਦੇ ਹਾਂ ਠੀਕ ਹੈ ਇਹ ਸ਼ਹੀਦਾਂ ਸਾਹਿਬ ਜਿਹੜੀ ਤਰਨ ਤਾਰਨ ਦੀ ਲੋੜ ਹੈ ਉਸ ਦੇ ਵਿਚਕਾਰ ਬਣਿਆ ਹੋਇਆ ਜਦੋਂ ਤਰਨ ਤਾਰਨ ਅੰਮ੍ਰਿਤਸਰ ਦੇ ਰੋਡ ਖ਼ਤਮ ਹੁੰਦੀ ਹੈ ਉੱਥੇ ਚੌਂਕ ਦੇ ਵਿੱਚ ਹੀ ਇਹ ਗੁਰਦੁਆਰਾ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਦੀ ਵੀ ਹਿਸਟਰੀ ਹੈ ਕਿ ਜਦੋਂ ਬਾਬਾ ਦੀਪ ਸਿੰਘ ਜੀ ਨੇ ਮੁਗਲ ਬਾਦਸ਼ਾਹ ਦੀ ਜਿਹੜੀ ਹਕੂਮਤ ਦੇ ਵਿੱਚੋਂ ਉਹਨਾਂ ਨੇ ਜੋ ਜ਼ੁਲਮ ਕਰ ਰਹੇ ਸੀ ਉਹਨਾਂ ਬਾਰੇ ਸੁਣਿਆ ਕਿ ਉਹ ਕਿਵੇਂ ਜਿਹੜਾ ਹਰਿਮੰਦਰ ਸਾਹਿਬ ਬਣਵਾਇਆ ਸੀ ਗੁਰੂ ਰਾਮਦਾਸ ਜੀ ਨੇ ਉਹਦੀ ਪਵਿੱਤਰਤਾ ਨੂੰ ਭੰਗ ਕਰ ਰਹੇ ਆ ਤਾਂ ਫਿਰ ਉਹਨਾਂ ਨੇ ਉਸ ਦਾ ਬਦਲਾ ਲੈਣ ਵਾਸਤੇ ਮੁਗਲਾਂ ਦੇ ਨਾਲ ਟਾਕਰਾ ਲਿਆ ਅਤੇ ਇਸੇ ਤਰਨ ਤਾਰਨ ਰੋਡ ਦੇ ਉੱਤੇ ਅ ਜਿੱਥੇ ਹੁਣ ਟਾਹਲਾ ਸਾਹਿਬ ਗੁਰਦੁਆਰਾ ਹੈ ਉਸ ਜਗ੍ਹਾ ਤੋਂ ਮੁਗਲਾਂ ਦੇ ਨਾਲ ਜੰਗ ਆਰੰਭ ਕੀਤੀ ਅਤੇ ਉੱਥੋਂ ਲੜਦੇ ਲੜਦੇ ਉਹ ਜਦੋਂ ਅੱਗੇ ਆ ਰਹੇ ਸੀ ਤਾਂ ਇੱਕ ਮੁਗਲ ਸਿਪਾਹੀ ਕੋਲੋਂ ਉਹਨਾਂ ਦਾ ਸੀਸ ਧੜ ਨਾਲੋਂ ਵੱਖਰਾ ਹੋ ਗਿਆ ਅਤੇ ਬਾਬਾ ਦੀਪ ਸਿੰਘ ਜੀ ਨੇ ਲੜਾਈ ਤੋਂ ਪਹਿਲਾਂ ਅ ਪ੍ਰਤਿਗਿਆ ਕੀਤੀ ਸੀ ਕਿ ਉਹ ਆਪਣਾ ਜਿਹੜਾ ਸੀਸ ਹੈ ਉਹ ਹਰਿਮੰਦਰ ਸਾਹਿਬ ਜਾ ਕੇ ਭੇਟ ਕਰਨਗੇ ਪਰ ਜਦੋਂ ਉਹਨਾਂ ਦਾ ਸੀਸ ਉੱਥੋਂ ਧੜ ਤੋਂ ਅਲੱਗ ਹੋ ਗਿਆ ਤਾਂ ਉਹਨਾਂ ਦੇ ਸਿੰਘਾਂ ਨੇ ਉਹਨਾਂ ਨੂੰ ਵੰਗਾਰ ਕੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਆਪਣੀ ਸਹੁੰ ਪੂਰੀ ਕਰਨੀ ਸੀ ਅਤੇ ਇਹ ਗੱਲ ਸੁਣਦਿਆਂ ਹੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਇੱਕ ਹੱਥ ਵਿੱਚ ਆਪਣਾ ਸੀਸ ਚੁੱਕ ਲਿਆ ਔਰ ਦੂਸਰੇ ਹੱਥ ਵਿੱਚ ਖੰਡਾ ਫੜ ਕੇ ਮੁਗਲਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਇਹ ਕੌਤਕ ਦੇਖ ਕੇ ਜਿਹੜੇ ਮੁਗਲ ਸੀ ਉਹ ਤਾਂ ਭੱਜ ਨੱਠ ਕੇ ਭੱਜੇ ਇੱਥੋਂ ਔਰ ਅੱਗੇ ਲੱਗ ਕੇ ਭੱਜਣ ਨੂੰ ਅੱਗੇ ਫਿਰ ਮੁਗ ਬਾਬਾ ਜੀ ਉਹਨਾਂ ਦੇ ਨਾਲ ਲੜਦਿਆਂ ਲੜਦਿਆਂ ਅੱਗੇ ਤੱਕ ਪਹੁੰਚੇ ਅਤੇ ਉਹਨਾਂ ਨੇ ਜੰਗ ਫਤਿਹ ਕੀਤੀ ਅਤੇ ਆਪਣਾ ਜਿਹੜਾ ਸੀਸ ਹੈ ਉਹ ਹਰਿਮੰਦਰ ਸਾਹਿਬ ਜੀ ਜਾ ਕੇ ਭੇਟ ਕੀਤਾ ਅਤੇ ਹੁਣ ਜਿੱਥੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਆ ਉੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਜਿੱਥੇ ਹੁਣ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਹੈ ਉਹ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਅਤੇ ਇੱਕ ਹੋਰ ਗੁਰਦੁਆਰਾ ਬੇਟਾ ਜੀ ਇੱਥੇ ਗੁਰੂ ਕੇ ਮਹਿਲ ਜੋ ਕਿ ਐਥਾਂ ਸ਼ਹਿਰ ਦੇ ਵਿਚਕਾਰ ਬਣਿਆ ਹੋਇਆ ਹੈ ਇੱਥੇ ਜਿਹੜੇ ਨੌਵੇਂ ਪਾਤਸ਼ਾਹੀ ਜੀ ਹੈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਵੀ ਜਨਮ ਹੋਇਆ ਸੀ ਠੀਕ ਹੈ ਬੇਟਾ ਹਾਂ ਇਹ ਯਾਦ ਰੱਖਣਾ ਆਪਣੀ ਗੱਲਾਂ ਠੀਕ ਹੈ ਹਾਂ ਓਕੇ ਬੇਟਾ